ਤੁਸੀਂ ਪੰਜਾਬ ਦੇ ਨੌਜਵਾਨ ਹੋਣ ਦੇ ਨਾਤੇ ਪੰਜਾਬ ਦੀ ਨੌਜਵਾਨੀ ਦੀਆਂ ਕਿਹੜੀਆਂ ਕਿਹੜੀਆਂ ਸਮੱਸਿਆਵਾਂ ਬਾਰੇ ਜਾਣਦੇ ਹੋ ਇਹਦੇ ਨਾਲ ਸਾਨੂੰ ਇਹ ਵੀ ਦੱਸੋ ਕਿ ਪੰਜਾਬ ਦੇ ਵਿੱਚ ਹੋਰ ਕਿਹੜੇ ਜਿਹੜੇ ਜਿਹੜੇ ਧਰਮ ਆ ਕਿਹੜੇ ਕਿਹੜੇ ਪ੍ਰਚਲਿੱਤ ਜ਼ਿਆਦਾਤਰ ਮਾਨਤਾ ਕਿਹੜੇ ਧਰਮ ਦੀ ਆ ਕੀ ਪੰਜਾਬ ਦੇ ਲੋਕ ਆਪਣੇ ਵਿਸ਼ਿਸ਼ਟ ਧਰਮ ਤੋਂ ਇਲਾਵਾ ਵੀ ਕਿਸੇ ਹੋਰ ਧਰਮ ਸਥਾਨਾਂ 'ਤੇ ਜਾਂਦੇ ਆ ਜਾਂ ਕਿਸੇ ਹੋਰ ਧਰਮ ਸਥਾਨਾਂ ਦੀ ਪੂਜਾ ਕਰਦੇ ਆ ਉਹਨਾਂ ਦੇ ਪੂਜਾ ਕਰਨ ਦੇ ਢੰਗ ਦੱਸੋ ਅਤੇ ਹੋਰ ਵੀ ਤੁਹਾਨੂੰ ਦੱਸੋ ਕਿ ਪੰਜਾਬ ਦੇ ਜਿਹੜੇ ਖਾਣੇ ਉਹਨਾਂ ਬਾਰੇ ਤੁਸੀਂ ਕੀ ਜਾਣਦੇ ਹੋ ਠੀਕ ਹੈ ਪੰਜਾਬ ਦੀ ਨੌਜਵਾਨੀ ਅੱਜ ਕੱਲ੍ਹ ਬਹੁਤ ਸਾਰੀਆਂ ਸਮੱਸਿਆਵਾਂ ਨਾਲ ਜੂਝ ਰਹੀ ਹੈ ਬੇਰੁਜ਼ਗਾਰੀ ਇੱਕ ਮੁੱਖ ਸਮੱਸਿਆ ਹੈ ਉਹ ਭਾਵੇਂ ਪੰਜਾਬ ਹੋਵੇ ਜਾਂ ਭਾਰਤ ਦਾ ਕੋਈ ਵੀ ਸੂਬਾ ਅੱਜ ਕੱਲ੍ਹ ਨੌਜਵਾਨਾਂ ਨੂੰ ਪੜ੍ਹ ਲਿਖ ਕੇ ਵੀ ਨੌਕਰੀਆਂ ਨਹੀਂ ਮਿਲਦੀਆਂ ਜੇ ਕੋਈ ਆਪਣਾ ਹੱਥੀਂ ਕੰਮ ਵੀ ਸਿੱਖ ਲੈਂਦਾ ਹੈ ਤਾਂ ਉਸ ਨੂੰ ਆਪਣੇ ਕੰਮ ਲਈ ਕੋਈ ਨਜ਼ਦੀਕੀ ਮੰਡੀ ਜਾਂ ਸਟੋਰ ਨਹੀਂ ਮਿਲਦਾ ਇਸ ਲਈ ਸ਼ਿਲਪਕਾਰੀ ਜਾਂ ਕਲਾ ਵੀ ਉਹਨਾਂ ਲਈ ਰੁਜ਼ਗਾਰ ਦਾ ਉਚਿੱਤ ਵਸੀਲਾ ਨਹੀਂ ਬਣ ਸਕਦੀ ਜੇ ਕੋਈ ਪੜ੍ਹਿਆ ਲਿਖਿਆ ਨੌਜਵਾਨ ਕੋਈ ਨੌਕਰੀ ਦਾ ਫਾਰਮ ਵੀ ਭਰਦਾ ਹੈ ਤਾਂ ਕਈ ਵਾਰ ਉਸਦੀ ਫੀਸ ਬਹੁਤ ਜ਼ਿਆਦਾ ਹੁੰਦੀ ਹੈ ਦੂਸਰਾ ਉਹਨਾਂ ਨੌਕਰੀ ਦੀਆਂ ਅਸਾਮੀਆਂ ਲਈ ਪੇਪਰ ਹੁੰਦਾ ਹੈ ਉਹ ਉਹਨਾਂ ਦੀ ਮਾਤ ਭਾਸ਼ਾ ਵਿੱਚ ਨਹੀਂ ਹੁੰਦਾ ਇਸ ਲਈ ਉਹਨਾਂ ਨੂੰ ਪੇਪਰ ਦੇਣ ਵਿੱਚ ਵੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਜੇ ਕੋਈ ਨੌਜਵਾਨ ਉੱਚ ਸਿੱਖਿਆ ਲਈ ਕਿਤੇ ਪੜ੍ਹਾਈ ਕਰਨ ਜਾਂਦਾ ਹੈ ਤਾਂ ਉੱਥੇ ਉਸਦੇ ਖਰਚੇ ਬਹੁਤ ਹੁੰਦੇ ਹਨ ਅਤੇ ਗਰੀਬ ਪਰਿਵਾਰਾਂ ਕੋਲ ਇੰਨੇ ਪੈਸੇ ਨਹੀਂ ਹੁੰਦੇ ਕਿ ਉਹ ਬੱਚੇ ਦੀ ਪੜ੍ਹਾਈ ਦਾ ਖਰਚਾ ਚੁੱਕ ਸਕਣ ਇਸ ਲਈ ਸਮੇਂ ਦੀਆਂ ਸਰਕਾਰਾਂ ਨੂੰ ਚਾਹੀਦਾ ਹੈ ਕਿ ਨੌਜਵਾਨਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨ ਅਤੇ ਉਹਨਾਂ ਦੀ ਰੁਜ਼ਗਾਰ ਦੀ ਪੂਰਤੀ ਦੇ ਵਸੀਲੇ ਕਰਨ ਪੰਜਾਬ ਵਿੱਚ ਸਿੱਖ ਧਰਮ ਦੀ ਗਿਣਤੀ ਜ਼ਿਆਦਾ ਹੈ ਪਰ ਸਿੱਖ ਧਰਮ ਤੋਂ ਇਲਾਵਾ ਪੰਜਾਬ ਵਿੱਚ ਬਹੁਤ ਸਾਰੇ ਧਰਮਾਂ ਦੇ ਲੋਕ ਰਹਿੰਦੇ ਹਨ ਜਿਵੇਂ ਮੁਸਲਮਾਨ ਇਸਾਈ ਬੁੱਧ ਜੈਨੀ ਪੁਰਾਤਨ ਸਮਿਆਂ ਵਿੱਚ ਪੰਜਾਬ ਵਿੱਚ ਬਹੁਤ ਸਾਰੇ ਬਾਹਰੀ ਹਮਲਾਵਰ ਆਏ ਕਈ ਧਰਮਾਂ ਦੇ ਰਾਜਿਆਂ ਨੇ ਰਾਜ ਕੀਤਾ ਇਸ ਲਈ ਪੰਜਾਬ ਬਹੁਤ ਧਾਰਮਿਕ ਸੂਬਾ ਬਣ ਗਿਆ ਪੰਜਾਬ ਦੇ ਲੋਕ ਮੰਦਰਾਂ ਵਿੱਚ ਵੀ ਜਾਂਦੇ ਹਨ ਅਤੇ ਡੇਰਿਆਂ ਵਿੱਚ ਵੀ ਪੰਜਾਬ ਵਿੱਚ ਪਖੰਡਵਾਦ ਬਹੁਤ ਵਧ ਗਿਆ ਹੈ ਪੰਜਾਬ ਦੇ ਕਈ ਇਲਾਕਿਆਂ ਦੇ ਲੋਕ ਜਾਦੂ ਟੂਣਿਆਂ ਵਿੱਚ ਵੀ ਵਿਸ਼ਵਾਸ ਕਰਦੇ ਆ ਇਸ ਤੋਂ ਇਲਾਵਾ ਪੰਜਾਬ ਵਿੱਚ ਬਹੁਤ ਸਾਰੇ ਡੇਰੇ ਵੀ ਬਣੇ ਹਨ ਲੋਕ ਡੇਰਿਆਂ ਵਿੱਚ ਵੀ ਜਾਂਦੇ ਹਨ ਇਸਾਈ ਧਰਮ ਵੀ ਤੇਜ਼ੀ ਨਾਲ ਪੰਜਾਬ ਵਿੱਚ ਪੈਰ ਪਸਾਰ ਰਿਹਾ ਹੈ ਪੰਜਾਬ ਵਿੱਚ ਡੇਰਿਆਂ ਦੇ ਮੁਖੀ ਪੰਜਾਬ ਦੇ ਭੋਲੇ ਭਾਲੇ ਲੋਕਾਂ ਨੂੰ ਲੁੱਟ ਖਸੁੱਟ ਕਰ ਰਹੇ ਹਨ ਇਸ ਲਈ ਸਰਕਾਰ ਨੂੰ ਪਖੰਡਵਾਦ ਖਤਮ ਕਰਨ ਲਈ ਢੁਕਵੇਂ ਹੱਲ ਲੱਭਣੇ ਚਾਹੀਦੇ ਹਨ ਪੰਜਾਬ ਦੇ ਖਾਣਿਆਂ ਵਿੱਚ ਸਰਦੀ ਦੇ ਮਹੀਨਿਆਂ ਵਿੱਚ ਸਰੋਂ ਦਾ ਸਾਗ ਅਤੇ ਮੱਕੀ ਦੀ ਰੋਟੀ ਬਹੁਤ ਮਸ਼ਹੂਰ ਹੈ ਉਸ ਤੋਂ ਇਲਾਵਾ ਪੰਜਾਬ ਵਿੱਚ ਸਰਦੀਆਂ ਦੇ ਮੌਸਮ ਵਿੱਚ ਲੋਕ ਦੁੱਧ ਤੋਂ ਖੋਆ ਤਿਆਰ ਕਰਦੇ ਹਨ ਅਤੇ ਉਹਨਾਂ ਦੀਆਂ ਪਿੰਨੀਆਂ ਬਣਾ ਕੇ ਰੱਖ ਲੈਂਦੇ ਹਨ ਅਤੇ ਸਾਰੀ ਸਰਦੀ ਉਹਨਾਂ ਨੂੰ ਵਰਤਿਆ ਜਾਂਦਾ ਹੈ ਅਤੇ ਰਿਸ਼ਤੇਦਾਰਾਂ ਨੂੰ ਦਿੱਤਾ ਜਾਂਦਾ ਹੈ ਇਸ ਤੋਂ ਇਲਾਵਾ ਲੋਹੜੀ ਦੇ ਤਿਉਹਾਰ 'ਤੇ ਲੋਕ ਪਿੰਨੀਆਂ ਬਣਾ ਕੇ ਆਪਣੇ ਕੁੜੀਆਂ ਨੂੰ ਉਸਦੇ ਸਹੁਰਿਆਂ ਘਰ ਭੇਜਦੇ ਹਨ ਤਾਂ ਜੋ ਇਸ ਨਾਲ ਉਹਨਾਂ ਦਾ ਮੋਹ ਪਿਆਰ ਬਣਿਆ ਰਹਿੰਦਾ ਹੈ ਅਤੇ ਤਿਉਹਾਰ ਦੀ ਲ਼ੋਹੜੀ ਵੀ ਦੇ ਦਿੱਤੀ ਜਾਂਦੀ